ਮੇਰੀ ਮਨਪਸੰਦ ਕਿਤਾਬ ਹੈ ਮੇਰਾ ਦਾਗਿਸਤਾਨ ਮਾਂ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕਿਤਾਬਾਂ ਹਨ ਜੋ ਮੈਨੂੰ ਚੰਗੀਆਂ ਲੱਗਦੀਆਂ ਹਨ ਪਰ ਇਹ ਮੇਰੀਆਂ ਸਭ ਤੋਂ ਵੱਧ ਪਸੰਦੀਦੀ ਦੀਆਂ ਕਿਤਾਬਾਂ ਹਨ ਪੰਜਾਬੀ ਭਾਸ਼ਾ ਨਾਲ ਮੇਰਾ ਖਾਸ ਲਗਾਉ ਹੈ ਮੈਨੂੰ ਕਵਿਤਾ ਲਿਖਣਾ ਚੰਗਾ ਲੱਗਦਾ ਹੈ ਅਤੇ ਮੈਂ ਪੰਜਾਬੀ ਭਾਸ਼ਾ ਵਿੱਚ ਹੀ ਲਿਖਦੀ ਹਾਂ ਲਿਖਣ ਲਈ ਪ੍ਰੇਰਿਤ ਕਰਦੀਆਂ ਹਨ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀਆਂ ਇਹ ਕਹਿ ਸਕਦੇ ਹਾਂ ਕਿ ਕਲਪਨਾਵਾਂ ਜਾਂ ਆਲੇ ਦੁਆਲੇ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੋ ਤੁਹਾਡੇ ਨਾਲ ਬੀ ਬੀਤਦੀਆਂ ਨੇ ਉਹ ਖਿਆਲ ਜੋ ਤੁਹਾਡੇ ਮਨ 'ਚ ਆਉਂਦੇ ਨੇ ਜਾਂ ਉਹ ਘਟਨਾਵਾਂ ਜੋ ਤੁਹਾਡੇ ਸੰਗ ਘਟਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਪਿੰਡੇ ਤੋਂ ਹੰਢਾਉਂਦੇ ਹੋ ਅਤੇ ਕਦੇ ਨਾ ਕਦੇ ਉਹ ਸ਼ਬਦਾਂ ਦਾ ਜਾਮਾ ਪਾ ਕੇ ਕਵਿਤਾ ਦਾ ਰੂਪ ਲੈ ਲੈਂਦੀਆਂ ਨੇ ਜਾਂ ਕੋਈ ਖਿਆਲ ਤੁਹਾਡੇ ਮਨ 'ਚ ਆਇਆ ਤੁਸੀਂ ਉਸਨੂੰ ਕਵਿਤਾ ਬਣਾ ਕੇ ਲਿਖ ਦਿੱਤਾ ਕਹਿੰਦੇ ਨੇ ਨਾ ਕਿ ਮਨ ਦਾ ਹਾਲ ਸੁਣਾਵੇ ਕਵਿਤਾ ਜਿਹੜੀ ਗੱਲ ਕਹੀ ਨਾ ਜਾਵੇ ਕਾਗਜ਼ ਦੀ ਹਿੱਕ 'ਤੇ ਲਿਖ ਜਾਵੇ ਕਵਿਤਾ ਬਸ ਸੋ ਕਵਿਤਾ ਜਿਹੜਾ ਹੈ ਉਹ ਪਤਾ ਨਹੀਂ ਲੱਗਦਾ ਕਦੋਂ ਕਿੱਥੇ ਉੱਤਰਦੀ ਹੈ ਅਤੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਆਪ ਮੁਹਾਰੇ ਹੀ ਪ੍ਰੇਰਿਤ ਕਰ ਜਾਂਦੀਆਂ ਨੇ ਹੁਣ ਮੈਂ ਤੁਹਾਡੇ ਨਾਲ ਆਪਣੀ ਇੱਕ ਛੋਟੀ ਜਿਹੀ ਕਵਿਤਾ ਸਾਂਝੀ ਕਰਦੀ ਹਾਂ ਜੇਕਰ ਬੁੱਧ ਦੀ ਪਤਨੀ ਵੀ ਉਸ ਵਾਂਗ ਸੱਚ ਦੀ ਤਲਾਸ਼ ਲਈ ਰਾਤ ਨੂੰ ਪੁੱਤਰ ਅਤੇ ਪਤੀ ਨੂੰ ਸੁੱਤਿਆਂ ਛੱਡ ਕੇ ਤੁਰ ਜਾਂਦੀ ਹਾਸਲ ਵੀ ਕਰ ਲੈਂਦੀ ਗਿਆਨ ਮਾਰਗ ਪਰ ਉਸਨੇ ਕਦੇ ਵੀ ਉਦਲ ਗਈ ਤੋਂ ਮਹਾਤਮਾ ਨਹੀਂ ਸੀ ਹੋਣਾ ਇਸ ਤਰ੍ਹਾਂ ਹੀ ਇੱਕ ਹੋਰ ਹੈ ਗਜ਼ਲ ਦਾ ਰੂਪ ਮੇਰੇ ਪਲਕਾਂ ਦੇ ਬੂਹੇ 'ਤੇ ਤੇਰਾ ਖਿਆਲ ਆਇਆ ਹੈ ਮੈਂ ਅੱਖੀਆਂ ਖੋਲ੍ਹਦਾ ਜਾ ਕੇ ਬੂਹੇ ਢੋਅ ਲਵਾਂ ਸਾਥੀ ਇਸ਼ਕ ਦਾ ਜਾਮ ਹੈ ਭਰਿਆ ਹੱਥੀਂ ਮਦਮਸਤ ਪਿਆਲੇ ਨੇ ਮੈਂ ਕਿੱਦਾਂ ਪੀ ਲਵਾਂ ਤਨਹਾ ਕੋਲ ਜੇ ਤੂੰ ਨਹੀਂ ਸਾਥੀ ਕੌਣ ਇਸ ਨੂੰ ਸਮਝਾਵੇ ਕਿ ਝੱਟ ਕੁ ਠਹਿਰ ਕੇ ਆਵੇ ਹਾਲੇ ਤਾਂ ਚੰਨ ਵੀ ਝਾਕ ਕੇ ਬੱਦਲਾਂ ਦੀ ਖੋਲ੍ਹ ਕੇ ਤਾਕੀ ਮੈਂ ਕਾਮੇ ਮਜ਼ਦੂਰ ਦੀ ਧੀ ਹਾਂ ਨਾ ਚੂਚਕ ਦੀ ਜਾਈ ਵੇ ਤੇਰੇ ਇਸ਼ਕ ਤੋਂ ਮਹਿੰਗੀ ਨਾ ਕਰਾਂ ਬਗ ਪੱਗ ਬਾਬਲੇ ਦੀ ਦਾਗੀ ਰੁੱਤ ਬੇਫਿਕਰੀ ਵਾਲੀ ਸਾਡੇ ਹਿੱਸੇ ਨਹੀਂ ਆਉਣੀ ਸਾਡੇ ਸਾਹਾਂ ਨੇ ਕਰਨੀ ਖੁਦ ਉਮਰਾਂ ਦੀ ਬੇਰਾਕੀ ਸੋ ਇਸ ਤਰ੍ਹਾਂ ਦੀਆਂ ਬਹੁਤ ਬਹੁਤ ਅਣਗਿਣਤ ਕਵਿਤਾਵਾਂ ਅਤੇ ਕਾਵਿ ਸੰਗ੍ਰਹਿ ਮੇਰੇ ਛਪ ਚੁੱਕੇ ਹਨ